ਮੇਰਾ ਨੋਕੀਆ ਦਾ ਮੋਬਾਇਲ ਜੋ ਕਿ ਇਹ ਮੇਰੇ ਬਜਟ 'ਚ ਸੀ ਇਹ ਮੈਂ ਫਸ ਪਹਿਲੀ ਵਾਰੀ ਖਰੀਦਿਆ ਅਤੇ ਇਸ ਦੀ ਕੀਮਤ ਸਤਾਰਾਂ ਹਜ਼ਾਰ ਰੁਪਈਆ ਸੀਗਾ ਅਤੇ ਇਸ ਦਾ ਸਭ ਤੋਂ ਵਧੀਆ ਮੈਨੂੰ ਕੈਮਰਾ ਲੱਗਿਆ ਜੋ ਕੈਮਰਾ ਯੂਜ਼ ਕਰਨ ਦੀ ਫੋਟੋ ਕਲੈਰਟੀ ਕਹਿ ਲਉ ਜਾਂ ਜ਼ੂਮਿੰਗ ਕਹਿ ਲਉ ਬਹੁਤ ਅੱਛੀ ਸੀ ਕੋਲਿੰਗ ਕੋਲਿੰਗ ਬਹੁਤ ਹੀ ਅੱਛੀ ਸੀਗੀ ਮੰਨ ਲਉ ਐੱਚ ਡੀ ਤੁਹਾਨੂੰ ਵੋਇਸ ਕੋਲਿੰਗ ਸੁਣਨ ਨੂੰ ਮਿਲਦੀ ਸੀਗੀ ਇਹਦੇ ਵਿੱਚ ਬੈਟਰੀ ਬੈਕਅੱਪ ਬਹੁਤ ਅੱਛਾ ਸੀਗਾ ਇੱਕ ਵਾਰ ਚਾਰਜ ਕਰਨ ਨਾਲ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਕੱਢ ਦਿੰਦਾ ਸੀਗਾ